ਕੋਈ ਵੀ ਕੁਦਰਤੀ ਪਦਾਰਥ ਜਿਸ ਨੂੰ ਮਨੁੱਖ ਵਰਤਦਾ ਹੈ ਉਸ ਨੂੰ ਕੁਦਰਤੀ ਸਰੋਤ ਮੰਨਿਆ ਜਾ ਸਕਦਾ ਹੈ ਇਹ ਕੁਦਰਤੀ ਸਰੋਤ ਤੇਲ ਕੋਲਾ ਕੁਦਰਤੀ ਗੈਸ ਧਾਤ ਜੰਗਲ ਖਣਿਜ ਪਦਾਰਥ ਸੂਰਜੀ ਸ਼ਕਤੀ ਸਮੁੰਦਰ ਆਦਿ ਜਿਵੇਂ ਕਿ ਅਰਬ ਕੰਟਰੀਆਂ ਤੇਲ ਨੂੰ ਵੇਚ ਕੇ ਵਪਾਰ ਕਰਦੀਆਂ ਹਨ ਅਸੀਂ ਵੀ ਗੈਸ ਨੂੰ ਵੇਚ ਕੇ ਵਪਾਰ ਕਰਦੇ ਹਾਂ ਧਾਤਾਂ ਨੂੰ ਵੇਚ ਕੇ ਵਪਾਰ ਕਰਦੇ ਹਾਂ ਅਸੀਂ ਆਪਣੀ ਆਮਦਨ ਨੂੰ ਦੁੱਗਣਾ ਕਰਦੇ ਹਾਂ ਅਤੇ ਦੇਸ਼ ਨੂੰ ਵੀ ਆਰਥਿਕ ਤੌਰ 'ਤੇ ਮਜ਼ਬੂਤ ਕਰਦੇ ਹਾਂ ਸੂਰਜੀ ਸ਼ਕਤੀ ਤੋਂ ਅਸੀਂ ਸੋਲਰ ਸਿਸਟਮ ਰਾਹੀਂ ਬਿਜਲੀ ਦਾ ਉਤਪਾਦ ਕਰਦੇ ਹਾਂ ਅਤੇ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਦੇ ਹਾਂ ਤੇਲ ਦੀ ਵਰਤੋਂ ਅਸੀਂ ਆਵਾਜਾਈ ਦੇ ਸਾਧਨਾਂ ਲਈ ਕਰ ਸਕਦੇ ਹਾਂ ਜੋ ਕਿ ਸਾਨੂੰ ਵਪਾਰ ਵਧਾਉਣ ਲਈ ਬਹੁਤ ਲਾਹੇਵੰਦ ਹੈ ਇਹ ਸਭ ਕੁਝ ਤੇਲ ਕੋਲਾ ਕੁਦਰਤੀ ਗੈਸ ਧਾਤ ਜੰਗਲ ਖਨਿਜ ਪਦਾਰਥ ਸੂਰਜੀ ਸ਼ਕਤੀ ਪਾਣੀ ਆਦਿ ਇਹਨਾਂ ਤੋਂ ਬਿਨਾਂ ਵਪਾਰ ਸੰਭਵ ਨਹੀਂ ਹੈ ਸਾਰੀ ਜ਼ਿੰਦਗੀ ਦਾ ਇਹ ਵੀ ਇੱਕ ਹਿੱਸਾ ਬਣ ਚੁੱਕੇ ਹਨ